ਅਸੀਂ ਘਰ ਦੇ ਵਿੱਚ ਵੱਖ ਵੱਖ ਪੀਣ ਵਾਲੀਆਂ ਚੀਜ਼ਾਂ ਬੜੇ ਸਸਤੇ ਤਰੀਕੇ ਨਾਲ਼ ਅਤੇ ਬੜੇ ਵਧੀਆ ਬਣਾ ਸਕਦੇ ਹਾਂ ਕਿਉਂਕਿ ਘਰ ਦੀ ਚੀਜ਼ ਦੀ ਕੋਈ ਕੀਮਤ ਨਹੀਂ ਹੁੰਦੀ ਉਹ ਬੜੀ ਸਾਫ਼ ਸੁਥਰੀ ਹੁੰਦੀ ਹੈ ਪਰ ਅਸੀਂ ਦੇਖਦੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਜਿਹੜਾ ਬਣਾ ਰਿਹਾ ਕਿਸੇ ਕਈ ਵਾਰੀ ਉਹਦੇ ਹੱਥ ਸਾਫ਼ ਨਹੀਂ ਹੁੰਦੇ ਜਾਂ ਉੱਤੇ ਮੱਖੀਆਂ ਮੱਛਰ ਹੋ ਰਹੇ ਹਨ ਅਤੇ ਜਾਂ ਜਿਹੜੇ ਬਰਤਨਾਂ ਦੇ ਵਿੱਚ ਉਹ ਸਾਨੂੰ ਪਾ ਕੇ ਪਰੋਸ ਰਿਹਾ ਉਹ ਸਾਫ਼ ਨਹੀਂ ਹੁੰਦੇ ਘਰ ਦੇ ਵਿੱਚ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ਼ ਉਹਨਾਂ ਚੀਜ਼ਾਂ ਨੂੰ ਬਣਾ ਸਕਦੇ ਹਾਂ ਜਿਵੇਂ ਨਿੰਬੂ ਵਾਲਾ ਪਾਣੀ ਬਨਾਨਾ ਸ਼ੇਕ ਮਿਲਕਸ਼ੇਕ ਪਪੀਤਾ ਸ਼ੇਕ ਅਤੇ ਕਈ ਤਰ੍ਹਾਂ ਦੇ ਡਰਿੰਕਸ ਜਿਹੜੇ ਹੈਗੇ ਹੈ ਉਹ ਵੀ ਅਸੀਂ ਆਪਣੇ ਘਰ ਦੇ ਵਿੱਚ ਬਣਾ ਸਕਦੇ ਹਾਂ ਘਰ ਦੀ ਬਣਾਈ ਚੀਜ਼ ਜਿੱਥੇ ਆਪਣੀ ਸਿਹਤ ਲਈ ਫਾਇਦੇਮੰਦ ਹੋਵੇਗੀ ਉੱਥੇ ਸਾਨੂੰ ਆਪਣੇ ਮਨ ਦੇ ਵਿੱਚ ਵੀ ਸਾਨੂੰ ਸੰਤੁਸ਼ਟੀ ਹੋਵੇਗੀ ਕਿ ਅਸੀਂ ਆਪ ਆਪਣੀ ਬੜੀ ਸਵੱਛਤਾ ਨਾਲ਼ ਇਸ ਚੀਜ਼ ਨੂੰ ਬਣਾਇਆ ਹੈ ਥੈਂਕ ਯੂ